ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਐਕਚੁਅਲੀ ਨਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਉਹ ਕਾਫੀ ਅੱਛੇ ਯੋਧਾ ਹੋਏ ਆ ਪੰਜਾਬ ਦੇ ਅਤੇ ਅੱਛੇ ਸ਼ਾਸਕ ਵੀ ਹੋਏ ਆ ਅਤੇ ਉਦੋਂ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬ ਨਾ ਕਾਫੀ ਬਿਖਰਿਆ ਹੋਇਆ ਸੀ ਅਲੱਗ ਅਲੱਗ ਮਿਸਲਾਂ 'ਚ ਵੰਡਿਆ ਹੋਇਆ ਸੀ ਅਤੇ ਉਹਨਾਂ ਨੇ ਫਿਰ ਮਿਸਲਾਂ ਨੂੰ ਇਕੱਠਾ ਕੀਤਾ ਅਤੇ ਪੰਜਾਬ ਨੂੰ ਇੱਕ ਕੀਤਾ ਅਤੇ ਇਹਨਾਂ ਦੀ ਯਾਦ ਵਿੱਚ ਗੋਬਿੰਦਗੜ੍ਹ ਕਿਲ੍ਹਾ ਵੀ ਬਣਿਆ ਹੋਇਆ ਅੰਮ੍ਰਿਤਸਰ 'ਚ ਕਾਫੀ ਅੱਛਾ ਵਾ ਜਾਣਕਾਰੀ ਦਾ ਕੇਂਦਰ ਇਹਨਾਂ ਦੀ ਦਾ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਮਿਲਾਂਗੇ ਮੈਮ ਜ਼ਰੂਰ ਠੀਕ ਹੈ ਹਾਂਜੀ ਹਾਂਜੀ ਮੈਮ ਕਿਸੇ ਟਾਈਮ ਵੀ ਠੀਕ ਓਕੇ ਜੀ ਵੈਲਕਮ